ਮੈਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਦੌੜ ਲਗਾਉਂਦਾ ਹਾਂ ਅਤੇ ਰੋਜ਼ ਜਿੰਮ ਜਾ ਕੇ ਸਵੇਰੇ ਵਰਕਆਊਟ ਕਰਦਾ ਹਾਂ ਇਸ ਦੇ ਨਾਲ਼ ਮੇਰੀ ਸਿਹਤ ਤਾਂ ਤੰਦਰੁਸਤ ਹੀ ਰਹਿੰਦੀ ਹੈ ਅਤੇ ਇਸ ਦੇ ਨਾਲ਼ ਮੇਰਾ ਹੋਰ ਵੀ ਸਵੇਰੇ ਤਾਜ਼ੀ ਹਵਾ ਮਿਲਦੀ ਹੈ ਅਤੇ ਸਵੇਰੇ ਸੂਰਜ ਦੀਆਂ ਕਿਰਨਾਂ ਤੋਂ ਪਹਿਲਾਂ ਉੱਠ ਕੇ ਹਰੀ ਘਾਸ ਦੇ ਨਾਲ਼ ਭੱਜਣ ਦੇ ਨਾਲ਼ ਸਾਡੀ ਨਿਗਾਹ ਵੀ ਤੇਜ਼ ਹੁੰਦੀ ਹੈ